ਹੈਲੋ ਟੀਮ ਮੈਂਬਰਸ ਨੂੰ ਸਾਰੇ ਕਲੀਗਸ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੂੰ ਵਧੀਆ ਹੋਪ ਹੋਵੋਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਪਕਮਿੰਗ ਇਵੈਂਟ ਆ ਰਿਹਾ ਸੋਸ਼ਲ ਈਵੈਂਟ ਅਤੇ ਮੈਨੂੰ ਟਾ ਮੈਂ ਸੋਚਿਆ ਕਿ ਮੈਂ ਇੱਕ ਮੂਵੀ ਫਨ ਮੂਵੀ ਨਾਈਟ ਔਰਗਨਾਈਜ਼ ਕਰਾਂ ਸਾਰਿਆਂ ਲਈ ਜਿਹਦੇ ਵਿੱਚ ਮੈਂ ਸੋਚਿਆ ਹੈ ਕਿ ਇੰਸਪੈਸ਼ਨ ਮੂਵੀ ਇੰਸਪੈਸ਼ਨ ਮੂਵੀ ਇੰਗਲਿਸ਼ ਮੂਵੀ ਰੱਖਾਂ ਜਿਹੜੀ ਕਿ ਬਹੁਤ ਵਧੀਆ ਹੈ ਜਿਹੜੀ ਦੋ ਹਜ਼ਾਰ ਦਸ ਵਿੱਚ ਰਿਲੀਜ਼ ਹੋਈ ਸੀ ਆਹ ਅਸੀਂ ਮੂਵੀ ਨਾਈਟ ਪਲੈਨ ਕੀਤੀ ਆ ਇਹ ਮੂਵੀ ਵਿੱਚ ਕਾਫੀ ਐਕਸ਼ਨ ਹੈ ਵਧੀਆ ਥ੍ਰੀਲਰ ਹੈ ਥੋੜ੍ਹਾ ਬਹੁਤ ਰੋਮੈਂਸ ਵੀ ਹੈ ਸਾਰੇ ਹੀ ਪਾਰਟਸ ਆ ਜਿਹੜਾ ਕਿ ਹਰ ਇੱਕ ਬੰਦੇ ਦੇ ਮੂੜ ਨੂੰ ਰੱ ਵੇ ਦੇਖਦਿਆਂ ਹੋਏ ਅਸੀਂ ਮੈਂ ਫਾਈਨਲਾਈਜ਼ ਕੀਤਾ ਹੈ ਸੋਚ ਰਿਹਾ ਹੈ ਅਜੇ ਕਿ ਜੋ ਸਾਰਿਆਂ ਨੂੰ ਵਧੀਆ ਲੱਗੇ ਮੈਨੂੰ ਮੈਂ ਇਹ ਮੇਕ ਸ਼ਿਓਰ ਕਰਨਾ ਹੈ ਕਿ ਮੈਂ ਕੁਛ ਦੋ ਤਿੰਨ ਸਕਰੀਨਿੰਗ ਟਾਈਮ ਮੈਂ ਚੂਜ਼ ਕੀਤੇ ਹਨ ਸਾਰਿਆਂ ਦੇ ਸਕੈਡਿਊਲ ਚੈੱਕ ਕਰਕੇ ਜਿਹੜੇ ਕਿ ਪੋਸੀਬਲ ਹੋਣ ਆਈ ਥਿੰਕ ਕਿ ਜਿਹੜੇ ਸਾਰੇ ਜਣੇ ਅਵੇਲੇਬਲ ਹੋਣ ਉਸ ਟਾਈਮ 'ਚ ਅਤੇ ਤੁਸੀਂ ਮੈਨੂੰ ਮੈਂ ਤੁਹਾਡਾ ਫੀਡਬੈਕ ਲੈਣਾ ਚਾਹੁੰਦਾ ਹਾਂ ਇਹ ਸਕਰੀਨਿੰਗ ਟਾਈਮ ਲਾ ਟਾਈਮ ਦਾ ਮੈਂ ਤਿੰਨ ਚਾਰ ਟਾਈਮ ਸਲੋਟਸ ਚੂਜ਼ ਕੀਤੇ ਹਨ ਥਰਸਡੇਅ ਨੂੰ ਸ਼ਾਮੀ ਸਾਢੇ ਛੇ ਵਜੇ ਸ਼ੁੱਕਰਵਾਰ ਨੂੰ ਸ਼ਾਮੀ ਸੱਤ ਵਜੇ ਸ਼ਨੀਵਾਰ ਨੂੰ ਸ਼ਾਮੀ ਅੱਠ ਵਜੇ ਅਤੇ ਐਤਵਾਰ ਨੂੰ ਦੁਪਹਿਰ ਬਾਰ੍ਹਾਂ ਵਜੇ ਇਹ ਚਾਰ ਟਾਈਮਿੰਗ ਮੈਂ ਸੋਚੇ ਹਨ ਜੇ ਕਿਸੇ ਨੂੰ ਜਿਹਨਾਂ ਨੂੰ ਵੀ ਜਿਹੜਾ ਟਾਈਮ ਸੂਟ ਕਰਦਾ ਹੈ ਇੱਕ ਵਾਰੀ ਮੈਨੂੰ ਸਾਰੇ ਜਣੇ ਆਪਦਾ ਰਿਪਲਾਈ ਕਰ ਦਿਓ ਅਤੇ ਕੋਈ ਵੀ ਜੇ ਕਓਸ਼ਨਸ ਹੋਵੇ ਕੁਛ ਵੀ ਹੋਵੇ ਤਾਂ ਪਲੀਜ਼ ਕਦੋਂ ਮਰਜ਼ੀ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਇੱਕ ਵਾਰੀ ਮੈਨੂੰ ਤੁਹਾਡਾ ਇਨਪੁੱਟ ਮਿਲ ਗਿਆ ਵੀ ਤੁਸੀਂ ਕਿਹੜੇ ਟਾਈਮ ਵਿੱਚ ਈਜ਼ਲੀ ਆ ਸਕਦੇ ਹੋ ਫਿਰ ਮੈਂ ਉਹ ਟਾਈਮ ਫਾਈਨਲਾਈਜ਼ ਕਰਕੇ ਮੂਵੀ ਰੱਖਾਂਗਾ ਅਤੇ ਇੰਜੋਏ ਕਰਾਂਗੇ ਆਪਾਂ ਸਾਰੇ ਮੂਵੀ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਬਹੁਤ ਖੁਸ਼ ਹਾਂ ਅਤੇ ਮੈਂ ਤੁਹਾਨੂੰ ਤੁਹਾਡੇ ਜਿਹੜੇ ਵੀ ਮੈਸੇਜਿਸ ਹਨ ਰਿਪਲਾਏ ਹਨ ਉਹ ਦੇਖਣਾ ਚਾਹੁੰਦਾ ਹਾਂ ਸੋ ਦੈਟ ਮੈਂ ਆਹ ਮੂਵੀ ਨਾਈਟ ਫਾਈਨਲਾਈਜ਼ ਕਰਾਂ ਅਤੇ ਆਪਾਂ ਇੰਜੋਏ ਕਰ ਸਕੀਏ ਥੈਂਕ ਯੂ